ਜੇਕਰ ਆਪਾਂ ਗੱਲ ਕਰੀਏ ਯੋਗਾ ਦੀ ਤਾਂ ਯੋਗਾ ਆਤਮਾ ਨੂੰ ਪਰਮਾਤਮਾ ਨਾਲ਼ ਮਿਲਾਉਣ ਦਾ ਬਹੁਤ ਪੁਰਾਣਾ ਰਾਹ ਹੈ ਪਹਿਲਾਂ ਬਹੁਤ ਸਾਰੇ ਰਿਸ਼ੀ ਮੁਨੀ ਜਦੋਂ ਤਪ ਕਰਦੇ ਸੀ ਤਾਂ ਉਹ ਯੋਗਾ ਦੇ ਰਾਹ ਨਾਲ਼ ਹੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸੀਗੇ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਯੁੱਗ ਦੀ ਤਾਂ ਅੱਜ ਕੱਲ੍ਹ ਦੇ ਟੈਕਨੋਲੋਜੀ ਦੇ ਯੁੱਗ ਵਿੱਚ ਯੋਗਾ ਬਹੁਤ ਜ਼ਿਆਦਾ ਲਾਭਦਾਇਕ ਹੈ ਆਪਣੀ ਮਾਨਸਿਕ ਅਤੇ ਸਰੀਰਿਕ ਵਿਕਾਸ ਵਾਸਤੇ ਕਿਉਂਕਿ ਹਰ ਕੋਈ ਬੰਦਾ ਅੱਜ ਕੱਲ੍ਹ ਸਟ੍ਰੈੱਸ ਲੈਂਦਾ ਹੈ ਬਹੁਤ ਸਾਰੇ ਅੱਜ ਕੱਲ੍ਹ ਤਾਂ ਕੀ ਹੁੰਦਾ ਹੈ ਕਿ ਸਾਰੇ ਹੀ ਵਰਕਿੰਗ ਹੋ ਗਏ ਨੇ ਸਾਰੇ ਕੰਮ ਕਾਜੀ ਹੋ ਗਏ ਨੇ ਤਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਟੈਂਸ਼ਨ ਹੈ ਜੇਕਰ ਆਪਾਂ ਛੋਟੀ ਉਮਰ ਤੋਂ ਵੱਡੀ ਉਮਰ ਤੱਕ ਦੀ ਗੱਲ ਕਰੀਏ ਤਾਂ ਇੱਕ ਛੋਟੇ ਬੱਚੇ ਨੂੰ ਪੜ੍ਹਾਈ ਦੀ ਟੈਂਸ਼ਨ ਹੈ ਵੱਡਿਆਂ ਨੂੰ ਆਪਣੇ ਕੰਮਕਾਰ ਦੀ ਟੈਂਸ਼ਨ ਹੈ ਬਜ਼ੁਰਗਾਂ ਨੂੰ ਆਪਣੀ ਸਿਹਤ ਦੀ ਟੈਨਸ਼ਨ ਹੈ ਤਾਂ ਇਸ ਚੀਜ਼ ਨੂੰ ਓਵਰਕਮ ਕਰਨ ਵਾਸਤੇ ਯੋਗਾ ਇੱਕ ਬਹੁਤ ਵਧੀਆ ਸਾਧਨ ਹੈ ਚਾਹੇ ਉਹ ਮੈਂਟਲੀ ਵਿਕਾਸ ਹੋਵੇ ਚਾਹੇ ਉਹ ਸਰੀਰਿਕ ਵਿਕਾਸ ਹੋਵੇ ਬਟ ਅੱਜ ਕੱਲ੍ਹ ਤਾਂ ਯੋਗਾ ਤੋਂ ਬਿਨਾਂ ਬਹੁਤ ਸਾਰੇ ਜਿੰਮ ਖੁੱਲ੍ਹ ਗਏ ਨੇ ਬਹੁਤ ਸਾਰੇ ਪ੍ਰੋਡਕਟ ਆ ਗਏ ਨੇ ਜਿਹੜੇ ਕਿ ਤੁਹਾਡੀ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਨੇ ਪਰ ਜਿਹੜਾ ਇੱਕ ਯੋਗਾ ਏ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਅਤੇ ਬਹੁਤ ਅੱਜ ਤੋਂ ਨਹੀਂ ਇਹ ਪਿਛੋਕੜ ਸਮੇਂ ਤੋਂ ਲੋਕਾਂ ਨੂੰ ਲਾਭ ਪਹੁੰਚਾਉਂਦਾ ਆ ਰਿਹਾ ਹੈ ਸੋ ਸਾਨੂੰ ਸਾਰਿਆਂ ਨੂੰ ਯੋਗਾ ਕਰਨਾ ਚਾਹੀਦਾ ਹੈ ਈਵਨ ਕਿ ਸਰਕਾਰ ਨੂੰ ਵੀ ਯੋਗੇ ਦੇ ਪ੍ਰਬੰਧ ਕਰਵਾਉਣੇ ਚਾਹੀਦੇ ਨੇ ਅਲੱਗ ਅਲੱਗ ਕਲਾਸਿਸ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਯੋਗਾ ਕਲਾਸ ਜ਼ਰੂਰ ਹੋਣੀ ਚਾਹੀਦੀ ਹੈ ਵੀਕ ਦੇ ਵਿੱਚ ਇੱਕ ਵਾਰ ਅਤੇ ਸਕੂਲਾਂ ਵਿੱਚ ਵੀ ਯੋਗਾ ਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ